ਹੈਲੋ ਤੁਸੀਂ ਸੁਖਮਨੀ ਟਰੈਵਲ ਤੋਂ ਬੋਲਦੇ ਪਏ ਹੋ ਮੈਂ ਪਿਛਲੀ ਵਾਰ ਮੇਰੀ ਸਿਸਟਰ ਆਈ ਹੋਈ ਸੀ ਅਤੇ ਉਹਨਾਂ ਦੇ ਬੱਚੇ ਵੀ ਨਾਲ ਆਏ ਦੇ ਸੀ ਅਤੇ ਆਪਾਂ ਤੁਹਾਡੀ ਜਿਹੜੀ ਆ ਉਹ ਕੈਬ ਬੁੱਕ ਕੀਤੀ ਸੀ ਉਹਦਾ ਜਿਹੜਾ ਆ ਉਹ ਬੜਾ ਹੀ ਵਧੀਆ ਰਿਹਾ ਉਹਦਾ ਜਿਹੜਾ ਡਰਾਈਵਰ ਸੀ ਉਹ ਬਹੁਤ ਹੀ ਵਧੀਆ ਸੀ ਆਪਾਂ ਘੁੰਮਣ ਗਏ ਸੀ ਉਹਨਾਂ ਦੇ ਨਾਲ ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਸੀ ਆਪਾਂ ਸਾਰੇ ਇਕੱਠੇ ਘੁੰਮਣ ਗਈ ਸੀ ਅਤੇ ਪਾਂ ਆਪਾਂ ਡਰਾਈਵਰ ਨੂੰ ਬੋਲਿਆ ਸੀ ਕਿ ਅਸੀਂ ਅੱਠ ਕੁ ਵਜੇ ਤੱਕ ਘਰ ਆ ਜਾਣਾ ਪਰ ਉਹਨਾਂ ਦੇ ਬੱਚੇ ਬਹੁਤ ਸ਼ਰਾਰਤੀ ਹਨ ਉਹ ਵਿੱਚ ਸ਼ਰਾਰਤਾਂ ਵੀ ਕਰੇ ਕਰਦੇ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਵੀ ਜਾਏ ਕਰਦੇ ਸੀ ਅਸੀਂ ਜਿੱਥੇ ਬੋਲਿਆ ਈ ਕਿ ਗੱਡੀ ਰੁਕਣ ਲਈ ਉੱਥੇ ਡਰਾਈਵਰ ਰੁਕੇ ਕਰਦਾ ਸੀ ਮਤਲਬ ਬ ਉਹਨਾਂ ਦਾ ਜਿਹੜਾ ਨੇਚਰ ਆ ਉਹ ਬਹੁਤ ਹੀ ਚੰਗਾ ਸੀ ਅਤੇ ਆਪਾਂ ਕਾਫੀ ਜਗ੍ਹਾ ਘੁੰਮਿਆ ਸੀ ਉਹ ਜਲ੍ਹਿਆਂਵਾਲਾ ਬਾਗ ਹਰਿਮੰਦਰ ਸਾਹਿਬ ਬੋਡਰ ਉਹਨਾਂ ਨੇ ਉਹਨਾਂ ਨੇ ਬਹੁ ਬਹੁਤ ਹੀ ਚੰਗੇ ਤਰੀਕੇ ਨਾਲ ਪੇਸ਼ ਆਏ ਸੀ ਅਤੇ ਮੈਂ ਹੁਣ ਮੇਰਾ ਭਰਾ ਆ ਰਿਹਾ ਬਾਹਰੋਂ ਅਤੇ ਉਹਨੂੰ ਲੈਣ ਲਈ ਆਪਾਂ ਦਿੱਲੀ ਏਅਰਪੋਰਟ ਜਾਣਾ ਅਤੇ ਮੈਂ ਉਹ ਹੀ ਡਰਾਈਵਰ ਉਹ ਹੀ ਕਾਬ ਕੈਬ ਜਿਹੜੀ ਆ ਬੁੱਕ ਕਰਨਾ ਚਾਹੁੰਦੀ ਹਾਂ ਕਿਉਂਕਿ ਉਹ ਕੈਬ ਦਾ ਐਕਸਪੀਰੀਅੰਸ ਬਹੁਤ ਵਧੀਆ ਸੀ ਅਤੇ ਉਹਦੇ ਉੱਪਰ ਕੈਰੀਅਰ ਵੀ ਲੱਗੇ ਹੋਏ ਆ ਜਿਹਦੇ ਵਿੱਚ ਕਿ ਉਹ ਉਹਦਾ ਜਿਹੜਾ ਸਾਰਾ ਸਮਾਨ ਆ ਉਹ ਆਰਾਮ ਨਾਲ ਆ ਸਕਦਾ ਅਤੇ ਮੈਂ ਮੈਨੂੰ ਉਹ ਡਰਾਈਵਰ ਦਾ ਨੰਬਰ ਦੇ ਦਿਓ ਤਾਂ ਜੋ ਮੈਂ ਉਹ ਹੀ ਕੈਬ ਬੁੱਕ ਕਰਵਾਵਾਂ ਅਤੇ ਉਹ ਹੀ ਸੇਮ ਡਰਾਈਵਰ ਹੋਵੇ